ਮੇਰਾ ਮੰਗਵਾਇਆ ਹੋਇਆ ਪਹਿਲਾ ਪ੍ਰੋਡਕਟ ਹੈ ਨੋਵਲ ਨੋਵਲ ਪੜ੍ਹਨਾ ਮੈਨੂੰ ਬਹੁਤ ਪਸੰਦ ਹੈ ਮੈਂ ਇਸ ਵਾਰ ਜੋ ਨੋਵਲ ਮੰਗਵਾਈ ਹੈ ਉਹ ਸਾਡੇ ਭਾਰਤ ਦੇ ਲਿਖੇ ਹੋਏ ਇੱਕ ਬਹੁਤ ਹੀ ਚੰਗੇ ਲੇਖਕ ਚੇਤਨ ਭਗਤ ਦੀ ਹੈ ਚੇਤਨ ਭਗਤ ਮੇਰੇ ਇੱਕ ਆਦਰਸ਼ ਹਨ ਮੈਂ ਉਹਨਾਂ ਤੋਂ ਸਿੱਖ ਕੇ ਅਤੇ ਉਹਨਾਂ ਦੀ ਨੋਬਲਸ ਪੜ੍ਹ ਕੇ ਅੱਗੇ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੀ ਹਾਂ ਅਤੇ ਭਵਿੱਖ ਵਿੱਚ ਇਸ ਬਾਰੇ ਲਿਖਣਾ ਵੀ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਨੋਵਲਜ਼ ਪੜ੍ਹਨਾ ਬਹੁਤ ਪਸੰਦ ਹੈ ਮੈਂ ਜੋ ਨੋਵਲ ਮੰਗਵਾਈ ਹੈ ਉਸ ਦਾ ਨਾਮ ਹੈ ਦ ਗਰਲ ਇਨ ਰੂਮ ਵੰਨ ਜ਼ੀਰੋ ਫਾਈਵ ਜੋ ਕਿ ਇੱਕ ਸੌ ਪੰਜ ਕਮਰੇ ਵਿੱਚ ਰਹਿ ਰਹੀ ਕੁੜੀ ਬਾਰੇ ਹੈ ਜਿਸ ਦੀ ਮ੍ਰਿਤਯੂ ਹੋ ਜਾਂਦੀ ਹੈ ਅਤੇ ਉਹ ਮਰੀ ਹੋਈ ਕੁੜੀ ਦੇ ਕੇਸ ਨੂੰ ਪਤਾ ਕਰਨ ਲਈ ਦੋ ਮੁੰਡੇ ਇੱਕ ਮਿਸ਼ਨ 'ਤੇ ਜੁੜ ਜਾਂਦੇ ਹਨ ਇਹ ਨੋਬਲ ਇੱਕ ਬਹੁਤ ਹੀ ਚੰਗੀ ਨੋਵਲ ਹੈ ਇਸ ਵਾਰ ਮੈਂ ਇਹ ਨੋਵਲ ਅਕਸਰ ਹੀ ਮੈਂ ਨੋਬਲਾਂ ਔਨਲਾਈਨ 'ਤੇ ਮੰਗਵਾਉਂਦੀ ਹਾਂ ਜਾਂ ਫਿਰ ਕਦੀ ਕਦੀ ਲਾਈਬ੍ਰੇਰੀ ਵੀ ਚੱਲ ਜਾਂਦੀ ਹਾਂ ਬਟ ਇਸ ਵਾਰ ਮੈਂ ਔਨਲਾਈਨ ਮੰਗਵਾਈ ਹੈ ਇਸ ਦੀ ਡਿਲਿਵਰੀ ਔਡਰ ਕਰਨ ਤੋਂ ਇੱਕ ਦੋ ਦਿਨ ਬਾਅਦ ਹੀ ਹੋ ਗਈ ਸੀ ਅਤੇ ਇਹ ਮੇਰਾ ਸਭ ਤੋਂ ਚੰਗਾ ਔਡਰ ਰਿਹਾ ਹੈ ਕਿਉਂਕਿ ਇਸ ਦੀ ਪੈਕੇਜਿੰਗ ਅਤੇ ਇਸ ਦੀ ਡਿਲੀਵਰੀ ਬਹੁਤ ਹੀ ਚੰਗੇ ਤਰੀਕੇ ਨਾਲ ਹੋਈ ਹੈ ਨੋਵਨ ਖੋਲ੍ਹਣ ਤੋਂ ਖੋਲ੍ਹਣ ਵਿੱਚ ਮੈਨੂੰ ਕੋਈ ਵੀ ਸਮੱਸਿਆ ਨਹੀਂ ਆਈ ਹੋਰ ਤਾਂ ਹੋਰ ਜਦੋਂ ਮੈਂ ਨੋਵਲ ਖੋਲ੍ਹੀ ਤਾਂ ਉਸ ਦੇ ਪੇਜ ਵੀ ਇਕਦਮ ਵਧੀਆ ਕੁਆਲਿਟੀ ਦੇ ਸਨ ਅਤੇ ਕੋਈ ਵੀ ਪ੍ਰਿੰਟਿੰਗ ਵਿੱਚ ਗਲਤੀ ਨਹੀਂ ਸੀ ਇਸ ਕਰਕੇ ਮੈਨੂੰ ਇਹ ਨੋਵਲ ਚੰਗੀ ਲੱਗੀ ਹੈ

ਚੰਗੀ ਲੱਗੀ ਹੈ ਨੋਵਲਜ਼ ਮੰਗਵਾਉਣਾ ਔਨਲਾਈਨ ਤੋਂ ਕਾਫੀ ਸਹੀ ਰਹਿੰਦਾ ਹੈ ਇਸ ਵਾਰ ਜੋ ਨੋਵਲ ਆਈ ਹੈ ਇਹ ਵੀ ਬਹੁਤ ਸਹੀ ਰਹੀ ਹੈ ਇਸ ਕਰਕੇ ਮੈਂ ਇੱਕ ਔਰ ਨੋਵਲ ਮੰਗਵਾਉਣ ਦਾ ਸੋਚ ਰਹੀ ਹਾਂ ਇਹ ਮੈਨੂੰ ਇਹ ਬਹੁਤ ਚੰਗਾ ਲੱਗਾ ਹੈ ਕਿ ਕਿਤਾਬਾਂ ਪੜ੍ਹਨ ਲਈ ਵੀ ਹੁਣ ਇੰਨੀ ਸੌਖ ਹੋ ਚੁੱਕੀ ਹੈ ਕਿ ਅਸੀਂ ਉਸ ਨੂੰ ਕਿਤੋਂ ਵੀ ਮੰਗਵਾ ਸਕਦੇ ਹਾਂ ਅਤੇ ਕੁਛ ਹੀ ਦਿਨਾਂ ਵਿੱਚ ਉਹ ਸਾਡੇ ਕੋਲ ਆ ਜਾਂਦੀ ਹੈ ਇਸੇ ਤਰ੍ਹਾਂ ਮੈਂ ਹੋਰ ਵੀ ਔਨਲਾਈਨ ਤੋਂ ਚੀਜ਼ਾਂ ਮੰਗਵਾਉਂਦੀ ਰਹਿੰਦੀ ਹਾਂ ਜਿਸ ਨਾਲ ਸਾਨੂੰ ਸੌਖ ਹੁੰਦੀ ਜਾਵੇ ਤਾਂ ਮੈਂ ਇਸ ਪ੍ਰੋਡਕਟ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਇਸ ਦੇ ਫੀਡਬੈਕ ਵਿੱਚ ਚੰਗੇ ਕਮੈਂਟਸ ਲਿਖ ਕੇ ਇਸ ਨੂੰ ਇੱਕ ਚੰਗੀ ਰੇਟਿੰਗ ਵੀ ਦੇਣਾ ਚਾਹੁੰਦੀ ਹਾਂ